ਜ਼ਿੰਦਗੀ ਵਿੱਚ ਜਿਵੇਂ ਕਲਰ ਦੀ ਬਹੁਤ ਵੱਡੀ ਅਹਿਮੀਅਤ ਹੈ ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਸੈਡ ਫੀਲ ਕਰਦੇ ਹਾਂ ਬਹੁਤ ਸੇ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਜਦੋਂ ਦੁੱਖ 'ਚ ਹੁੰਦੇ ਆ ਉਹ ਉਦੋਂ ਪੇਂਟਿੰਗਸ ਨੂੰ ਜਾਂ ਕਲਾ ਨੂੰ ਕਰਦੇ ਆ ਅਤੇ ਉਹ ਆਪਦੇ ਦਿਲ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਹੈੈੈੈੈੈ ਨਾ ਬਹੁਤ ਸੇ ਲੋਕ ਨੇ ਜਦੋਂ ਖੁਸ਼ ਹੁੰਦੇ ਨੇ ਤਾਂ ਉਸ ਖੁਸ਼ੀ ਨੂੰ ਆਪਣੇ ਕਾਗਜ਼ ਦੇ ਪੰਨੇ ਉੱਤੇ ਆਪਣੀ ਕਲਾ ਦੇ ਰੂਪ ਵਿੱਚ ਉਸਨੂੰ ਵਧੀਆ ਤਰੀਕੇ ਨਾਲ ਹੈ ਨਾ ਬਿਆਨ ਕਰਦੇ ਨੇ ਬਹੁਤ ਸੇ ਲੋਕ ਨੇ ਜਿਵੇਂ ਕੋਈ ਸਿੱਖਣ ਦੇ ਤੌਰ 'ਤੇ ਵੀ ਕਲਾ ਵਿੱਚ ਐਂਟਰ ਕਰਦਾ ਜਾਂ ਮਤਲਬ ਬਹੁਤ ਤਰੀਕੇ ਹੈਗੇ ਆ ਕਿ ਜਿਸਨੂੰ ਕਲਾ ਆਪਣੀ ਇੱਕ ਜ਼ਿੰਦਗੀ ਵਿੱਚ ਇੱਕ ਬਹੁਤ ਤਕੜੀ ਹਿਮ ਅਹਿਮੀਅਤ ਰੱਖਦਾ ਹੈ ਨਾ ਜਿਵੇਂ ਕਈਆਂ ਨੇ ਜੇ ਕਿਸੇ ਨੇ ਯੂਥ ਫੈਸਟੀਵਲ 'ਚ ਪਾਰਟੀਸਪੇਟ ਕਰਨਾ ਜਾਂ ਆਪਣੇ ਸਕੂਲ ਕੰਪਟੀਸ਼ਨ ਜਾਂ ਪਾਰਟੀਸੀਪੇਟ ਕਰਨਾ ਜਾਂ ਆਪਣੇ ਪਰੇਸ ਕਰਵਾਉਣੀ ਹੈ ਜਾਂ ਉਹਦੇ ਲਈ ਅੰਦਰ ਇੱਕ ਪ੍ਰਾਈਜ ਨੂੰ ਲੈ ਕੇ ਇੱਕ ਅੰਦਰ ਉਹਦੇ ਮੋਟਿਵ ਹੈ ਹਰ ਕਿਸੇ ਵੀ ਤਰ੍ਹਾਂ ਦਾ ਮੋਟਿਵ ਹੋ ਸਕਦਾ ਹੈ ਨਾ ਆਪਣੀ ਲਾਈਫ ਵਿੱਚ ਕਲਾ ਨੂੰ ਲੈ ਕੇ ਤਾਂ ਜਿਵੇਂ ਕਲਾ ਜੋ ਹੈ ਕਿ ਜੇ ਆਪਾਂ ਕੋਈ ਫ੍ਰੀ ਟਾਈਮ ਆਪਾਂ ਨੂੰ ਮਿਲ ਰਿਹਾ ਹੈ ਤਾਂ ਉਸ ਕਲਾ ਨੂੰ ਕੀਤਾ ਜਾ ਸਕੇ ਜਿਸ ਦੇ ਨਾਲ ਆਪਣਾ ਟਾਈਮ ਵੀ ਹੈ ਉਹ ਵੀ ਹੈ ਨਾ ਵਿਅਕਤ ਬਤੀਤ ਹੋ ਸਕੇ ਜਾਂ ਆਪਾਂ ਕਿਤੇ ਜਾਂਦੇ ਹਾਂ ਆਪਾਂ ਬਹੁਤ ਵਧੀਆ ਜੋ ਉੱਥੇ ਮਾਹੌਲ ਹੈ ਬਹੁਤ ਵਧੀਆ ਉੱਥੇ ਇਨਵਾਇਰਮੈਂਟ ਹੈ ਪਹਾੜਾਂ 'ਤੇ ਆਪਾਂ ਜੇ ਗਏ ਹਾਂ ਤਾਂ ਉਸ ਚੀਜ਼ ਨੂੰ ਆਪਾਂ ਜੇ ਹੱਥੀਂ ਕਲਾ ਕਰਕੇ ਉਸਨੂੰ ਇੱਕ ਕਾਗਜ਼ ਦੇ ਪੰਨੇ ਉੱਤੇ ਵਿਅਕਤ ਕੀਤਾ ਜਾ ਸਕੇ ਜਾਂ ਬਿਆਨ ਕੀਤਾ ਜਾ ਸਕੇ ਤਾਂ ਉਹ ਵੀ ਇੱਕ ਬਹੁਤ ਖੁਸ਼ੀ ਉਹਦਾ ਜਾਂ ਇੱਕ ਬਹੁਤ ਆਨੰਦ ਵਾਲਾ ਜਿਹੜਾ ਹੈ ਇੱਕ ਸੀਨ ਹੈ ਆਪਾਂ ਕਹਿ ਸਕਦੇ ਹਾਂ ਕਿ ਕਲਾ ਨੂੰ ਵਿਅਕਤ ਕਰਨ ਵਿੱਚ ਜਾਂ ਆਪਾਂ ਜਦੋਂ ਇੱਕ ਕਲਾ ਨੂੰ ਇੱਕ ਰੂਪ ਦਿੰਦੇ ਹਾਂ ਆਪਣੇ ਹੱਥ ਦੇ ਆਪਣੀ ਮਿਹਨਤ ਨਾਲ ਜਦੋਂ ਆਪਾਂ ਕਲਾ ਨੂੰ ਇੱਕ ਰੂਪ ਦਿੰਦੇ ਆ ਨਾ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਬਹੁਤ ਖੁਸ਼ੀ ਹੁੰਦੀ ਹੈ ਕਿ ਖੁਦ ਵਿੱਚ ਇੱਦਾਂ ਲੱਗਦਾ ਕਿ ਜਿਵੇਂ ਵੀ ਸਾਨੂੰ ਬਹੁਤ ਅਸੀਂ ਇੱਕ ਜਿਹੜੀ ਸਾਡੀ ਦੋ ਤਿੰਨ ਦਿਨ ਦੀ ਮਿਹਨਤ ਹੈ ਜਾਂ ਚਾਰ ਪੰਜ ਘੰਟੇ ਦੀ ਜਿਹੜੀ ਮਿਹਨਤ ਹੈ ਉਹ ਸਾਡੀ ਨਿੱਖਰ ਕੇ ਆ ਗਈ ਕਲਾ ਦਾ ਮਤਲਬ ਇਹੀ ਹੈ ਕਿ ਖੁਸ਼ ਹੋਵੇ ਭਾਵੇਂ ਦੁੱਖ ਹੋਵੇ ਆਪਣੀ ਫੀਲਿੰਗਸ ਨੂੰ ਆਪਣੀ ਭਾਵਨਾਵਾਂ ਨੂੰ ਆਪਣੀ ਸੋਚ ਨੂੰ ਜਾਂ ਆਪਾਂ ਕਿਸੇ ਨੂੰ ਮੈਸੇਜ ਪਹੁੰਚਾਉਣਾ ਕਿਸੇ ਨੂੰ ਸੰਦੇਸ਼ ਪਹੁੰਚਾਉਣੇ ਆਪਾਂ ਕੋਈ ਦੁਨੀਆ ਵਿੱਚ ਸੰਦੇਸ਼ ਦੇਣਾ ਚਾਹੁੰਦੇ ਹਨ ਜਾਂ ਕੁਝ ਸਹੀ ਕੀ ਹੈ ਗਲਤ ਕੀ ਹੈ ਉਹ ਆਪਾਂ ਆਪਣੀ ਕਲਾ ਦੇ ਦੌਰਾਨ ਵੀ ਲੋਕਾਂ ਵਿੱਚ ਪਹੁੰਚਾ ਸਕਦੇ ਹਾਂ ਆਪਾਂ ਜਾਗਰੂਕਤਾ ਵੀ ਫੈਲਾ ਸਕਦੇ ਹਾਂ ਤਾਂ ਕਲਾ ਇੱਕ ਬਹੁਤ ਵਧੀਆ ਅਹਿਮੀਅਤ ਅਹਿਮੀਅਤ ਦਿੰਦਾ ਹੈ ਆਪਣੀ ਜ਼ਿੰਦਗੀ ਵਿੱਚ ਤਾਂ ਆਪਾਂ ਕਈ ਤਰ੍ਹਾਂ ਦੇ ਆਪਾਂ ਜਿਹੜੇ ਸੰਦੇਸ਼ ਨੇ ਉਸਨੂੰ ਜਾਗਰੂਕਤਾ ਹੈ ਸੰਦੇਸ਼ ਹੈ ਆਪਾਂ ਦੁਨੀਆ ਵਿੱਚ ਉਸਨੂੰ ਪ੍ਰਚਲਿਤ ਕਰ ਸਕਦੇ ਹਾਂ ਆਪਣੀ ਕਲਾ ਦੇ ਦੌਰਾਨ ਇੱਕ ਕਲਾ ਜੋ ਹੈ ਇੱਕ ਸਭ ਤੋਂ ਮਹਿੰਗੀ ਅਤੇ ਕੀਮਤੀ ਚੀਜ਼ ਹੈ ਜਾਂ ਇੱਕ ਛੋਟੀ ਜਿਹੀ ਵੀ ਕਲਾ ਬਹੁਤ ਕੁਛ ਬਿਆਨ ਕਰਦੀ ਹੈ ਜ਼ਿੰਦਗੀ ਦੇ ਕਿਸੇ ਦੀ ਜ਼ਿੰਦਗੀ ਦੇ ਬਹੁਤ ਲਾਈਫ ਸਟੇਜਸ ਨੂੰ ਉਹਨਾਂ ਨੂੰ ਵੀ ਬਹੁਤ ਬਿਆਨ ਕਰਦੀ ਹੈ ਕਲਾ